ਮੇਰੇ ਜੀਵਨ ਦੀ ਸਭ ਤੋਂ ਵੱਡੀ ਚੜ੍ਹਾਈ ਹਿਮਾਲਿਆ ਪਰਬਤ ਦੀ ਇੱਕ ਚੋਟੀ ਹੈ ਇਹ ਬਹੁਤ ਮੁਸ਼ਕਿਲ ਸੀ ਪਰ ਮੈਂ ਬਚਪਨ ਤੋਂ ਹੀ ਪਰਬਤ ਚੜ੍ਹਨਾ ਚਾਹੁੰਦਾ ਸੀ ਮੈਂ ਰੋਜ਼ ਸੁਬਹ ਦੌੜ ਲਗਾਉਂਦਾ ਸੀ ਵੇਟ ਟ੍ਰੇਨਿੰਗ ਚੁੱਕਦਾ ਸੀ ਅਤੇ ਕਲਾਈਮਿੰਗ ਦੀ ਪ੍ਰੈਕਟਿਸ ਵੀ ਕਰਦਾ ਸੀ ਮੈਂ ਇਕਿਪਮੈਂਟ ਬਾਰੇ ਜਾਣਕਾਰੀ ਵੀ ਲੈਂਦਾ ਸੀ ਅਤੇ ਮੈਪ ਵੀ ਪੜ੍ਹਦਾ ਸੀ ਮੈਂ ਐਕਸਪੀਰੀਅੰਸ ਕਲਾਈਮਰਾਂ ਤੋਂ ਐਡਵਾਈਸ ਵੀ ਲਿੱਤੀ ਜੋ ਕਿ ਮੈਨੂੰ ਉਹ ਰਸਤੇ ਵਿੱਚ ਬਹੁਤ ਕੰਮ ਆਈ ਅਤੇ ਮੈਂ ਉਸ ਕਰਕੇ ਹੀ ਪਹਾੜੀ ਚੜ੍ਹ ਸਕਿਆ ਚੋਟੀ 'ਤੇ ਪਹੁੰਚਣ ਲਗਭਗ ਵੀਹ ਦਿਨ ਲੱਗ ਗਏ ਰਸਤੇ ਵਿੱਚ ਬਹੁਤ ਮੁਸ਼ਕਲਾਂ ਆਈਆਂ ਪਰ ਮੈਂ ਹਾਰ ਨਹੀਂ ਮੰਨੀ ਅਤੇ ਉਹ ਸਾਰੀਆਂ ਮੁਸ਼ਕਲਾਂ ਨੂੰ ਅੱਗੇ ਵੱਧ ਕੇ ਮੈਂ ਪਰਬਤ 'ਤੇ ਪਹੁੰਚਣਾ ਚਾਲੂ ਕੀਤਾ